ਸਤਿ ਸ਼੍ਰੀ ਅਕਾਲ ਸਾਰੇ ਜਣਿਆਂ ਨੂੰ ਮੈਂ ਤੁਹਾਨੂੰ ਸਾਰੇ ਜਣਿਆਂ ਨੂੰ ਆਪਣੇ ਇਸ ਖੇਤਰ ਦੇ ਬਾਰੇ ਦੱਸਣਾ ਚਾਹਾਂਗਾ ਇਸ ਖੇਤਰ ਦੇ ਵਿੱਚ ਬਥੇਰਾ ਹੀ ਤਰ੍ਹਾਂ ਦੇ ਲੱਖਾਂ ਹੀ ਤਰ੍ਹਾਂ ਦੇ ਪੰਛੀ ਰਹਿੰਦੇ ਹਨ ਫੇਰ ਉਹਨਾਂ ਵਿੱਚ ਜਿਹੜੇ ਆ ਉਹ ਕੁਝ ਜਿਹੜੇ ਆ ਉਹ ਸਾਨੂੰ ਜਿਹੜੇ ਆ ਆਮ ਸਾਡੀ ਜਿਹੜੀ ਨਿੱਜੀ ਜ਼ਿੰਦਗੀ ਉਹਦੇ ਵਿੱਚ ਵੇਖਣ ਨੂੰ ਮਿਲਦੇ ਆ ਉਹਨਾਂ ਵਿੱਚੋਂ ਚਿੜੀਆਂ ਕਬੂਤਰ ਕਾਂ ਇੱਲਾਂ ਅਤੇ ਬਗਲੇ ਅਤੇ ਮੋਰ ਅਤੇ ਤੋਤੇ ਜਿਹੜੇ ਆ ਉਹ ਸਾਨੂੰ ਜਿਹੜੇ ਆ ਆਮ ਹੀ ਸਾਨੂੰ ਨਿੱਜੀ ਜੀਵਨ ਦੇ ਵਿੱਚ ਇਹ ਦੇਖਣ ਨੂੰ ਮਿਲਦੇ ਆ ਸਾਡੇ ਰੁਟੀਨ ਦੇ ਵਿੱਚ ਇਹ ਵੱਖ ਵੱਖ ਪੰਛੀਆਂ ਦੀ ਜਿਹੜੀ ਆ ਆਪਣੀ ਇੰਪੋਟੈਂਨਸ ਵਾ ਆਪਣੀ ਇਹਨਾਂ ਦੀ ਮਹੱਤਤਾ ਵਾ ਹਰ ਇੱਕ ਪੰਛੀ ਜਿਹੜਾ ਵਾ ਉਹ ਆਪਣੇ ਹਿਸਾਬ ਦੇ ਨਾਲ ਜਿਹੜਾ ਵਾ ਉਹ ਜ਼ਿੰਦਗੀ ਜੀ ਰਿਹਾ ਵਾ ਕਿਸੇ ਦੀ ਜਿਹੜੀ ਆ ਉਹ ਕਿਸੇ ਦੀ ਕੋਈ ਚੀਜ਼ ਜਿਹੜੀ ਆ ਉਸ ਚੀਜ਼ ਨੂੰ ਲੈ ਕੇ ਉਹ ਮਹੱਤਵਪੂਰਨ ਵਾ ਕੋਈ ਜਿਹੜਾ ਵਾ ਪੰਛੀ ਜਿਹੜਾ ਵਾ ਉਹ ਹੋਰ ਕਿਸੇ ਚੀਜ਼ ਨੂੰ ਲੈ ਕੇ ਉਹਦੀ ਆਪਣੀ ਜਿਹੜੀ ਮਹੱਤਤਾ ਹੈਗੀ ਆ ਪਰ ਜੇਕਰ ਤੁਸੀਂ ਮੇਰੀ ਪਸੰਦੀਦਾਰ ਪੰਛੀ ਦੇ ਬਾਰੇ ਜਾਣਨ ਦੇ ਬਾਰੇ ਤੁਹਾਨੂੰ ਮੈਂ ਦੱਸਣਾ ਚਾਹਵਾਂਗਾ ਵੀ ਮੇਰਾ ਪਸੰਦੀਦਾ ਜਿਹੜਾ ਵਾ ਪੰਛੀ ਜਿਹੜਾ ਫੇਵਰੇਟ ਜਿਹੜਾ ਵਾ ਪੰਛੀ ਉਹ ਤੋਤਾ ਆ ਤੋਤਾ ਜਿਹੜਾ ਵਾ ਉਹ ਇੱਕ ਬਹੁਤ ਹੀ ਦਿਲਚਸਪ ਪੰਛੀ ਹੈਗਾ ਵਾ ਜਿਹਦਾ ਕਿ ਜਿੱਦਾਂ ਦੀ ਅਸੀਂ ਉਹਨੂੰ ਟ੍ਰੇਨਿੰਗ ਦਿੰਦੇ ਹਾਂ ਜਿਸ ਤਰ੍ਹਾਂ ਅਸੀਂ ਬੋਲਦੇ ਹਾਂ ਜੋ ਅਸੀਂ ਕਰਦੇ ਹਾਂ ਉਹ ਉਸ ਹੀ ਤਰ੍ਹਾਂ ਮੈਂ ਕਈ ਵਾਰੀ ਦੇਖਿਆ ਵਾ ਵੀ ਉਹ ਕਈ ਲੋਕਾਂ ਨੇ ਪਾਲਿਆ ਹੋਇਆ ਤੋਤਾ ਵਾ ਉਹ ਜੋ ਜੋ ਉਹਨੂੰ ਬੋਲੀਏ ਜਿਸ ਜਿਸ ਤਰ੍ਹਾਂ ਬੋਲੀਏ ਉਹ ਉਸ ਤਰ੍ਹਾਂ ਹੀ ਉਹ ਉਸਨੂੰ ਸਿੱਖਦਾ ਜਾਂਦਾ ਵਾ ਅਤੇ ਸਾਡਾ ਜਿਹੜਾ ਵਾ ਉਹਦੇ ਨਾਲ ਜਿਹੜਾ ਵਾ ਜਦੋਂ ਆਪਾਂ ਉਹਦੇ ਲਾਗੇ ਜਾ ਕੇ ਬੈਠੀਏ ਤਾਂ ਉਹ ਬਹੁਤ ਹੀ ਵਧੀਆ ਜਿਹੜਾ ਵਾ ਉਹ ਇੱਕ ਮਨੋਰੰਜਨ ਦਾ ਜਿਹੜਾ ਵਾ ਉਹ ਸਾਧਨ ਵੀ ਹੈਗਾ ਵਾ ਅਤੇ ਨਾਲ ਜਿਹੜਾ ਵਾ ਉਹ ਬਹੁਤ ਹੀ ਜਿਹੜਾ ਵੇਖਣ ਨੂੰ ਵੀ ਬਹੁਤ ਹੀ ਇੱਕ ਪਿਆਰਾ ਜਿਹੜਾ ਪੰਛੀ ਜਿਹੜਾ ਉਹ ਹੈਗਾ